ਮੇਰੀ ਯਾਦਗਾਰ ਯਾਤਰਾ ਪਾਉਂਟਾ ਸਾਹਿਬ ਦੀ ਹੈ ਜਿੱਥੇ ਪਹਿਲਾਂ ਮੈਂ ਸੋਚਦੀ ਹੁੰਦੀ ਸੀ ਕਿ ਮੈਂ ਉੱਥੇ ਉਸ ਚੜ੍ਹਾਈ 'ਤੇ ਨਹੀਂ ਚੜ੍ਹ ਸਕਾਂਗੀ ਪਰ ਜਦੋਂ ਮੈਂ ਉੱਥੇ ਪਹੁੰਚੀ ਤਾਂ ਮੈਨੂੰ ਬਿਲਕੁਲ ਵੀ ਡਰ ਨਹੀਂ ਲੱਗਿਆ ਮੈਂ ਆਸਾਨੀ ਨਾਲ਼ ਉੱਪਰ ਪਹੁੰਚ ਗਈ ਅਤੇ ਮੈਨੂੰ ਚੜ੍ਹਨੇ ਵਿੱਚ ਵੀ ਕੋਈ ਦਿੱਕਤ ਨਹੀਂ ਆਈ ਮੈਨੂੰ ਉਚਾਈ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਸੀ ਪਰ ਇਹ ਮੇਰਾ ਡ ਡਰ ਬਿਲਕੁਲ ਖ਼ਤਮ ਹੋ ਗਿਆ ਉੱਥੇ ਜਾ ਕੇ